ਕੁਝ ਸਮੇਂ ਪਹਿਲਾਂ ਮੈਂ ਇੱਕ ਲੈਪਟੋਪ ਖਰੀਦਣ ਦੀ ਯੋਜਨਾ ਬਣਾਈ ਸੀ ਐਮਜੋਨ ਐਪ 'ਤੇ ਉਸਨੂੰ ਮੈਂ ਆਪਣੇ ਸ਼ੋਪਿੰਗ ਕਾਰਟ ਅੰਦਰ ਐਡ ਕਰ ਲਿਆ ਸੀ ਪਰੰਤੂ ਮੈਂ ਉਸ ਨੂੰ ਆਰਡਰ ਕਰਦਾ ਇਸ ਤੋਂ ਪਹਿਲਾਂ ਹੀ ਉਹਦਾ ਰੇਟ ਵੱਧ ਗਿਆ ਸੀ ਇਸ ਲਈ ਮੈਂ ਉਹਨੂੰ ਆਪਣੀ ਸ਼ੋਪਿੰਗ ਕਾਰਟ ਵਿੱਚੋਂ ਹਟਾਉਣ ਦੀ ਯੋਜਨਾ ਬਣਾਈ ਅਤੇ ਉਸਨੂੰ ਹਟਾਉਣ ਲਈ ਮੈਂ ਐਮਜ਼ੋਨ ਐਪ ਨੂੰ ਓਪਨ ਕੀਤਾ ਮੈਂ ਆਪਣੀ ਸ਼ੋਪਿੰਗ ਕਾਰਟ ਅੰਦਰ ਗਿਆ ਅਤੇ ਉੱਥੇ ਸ਼ੋ ਹੋ ਰਹੇ ਡਿਲੀਟ ਬਟਨ ਨੂੰ ਕਲਿੱਕ ਕਰਕੇ ਉਸਨੂੰ ਮੈਂ ਆਪਣੇ ਸ਼ੋਪਿੰਗ ਕਾਰਟ ਵਿੱਚੋਂ ਹਟਾ ਦਿੱਤਾ ਅਤੇ ਇਹਦੀ ਪੁਸ਼ਟੀ ਕਰਨ ਲਈ ਮੈਂ ਉਸ ਪੇਜ ਨੂੰ ਫਰੈਸ਼ ਕੀਤਾ ਅਤੇ ਚੈਕ ਕੀਤਾ ਕਿ ਲੈਪਟੋਪ ਹਟ ਗਿਆ ਹੈ ਜਾਂ ਨਹੀਂ